ਇੱਕ ਲੱਖ ਨੌ ਪੱਚੀ ਹਜ਼ਾਰ ਦੋ ਸੌ ਨੌ ਇੱਕ ਲੱਖ ਦੋ ਹਜ਼ਾਰ ਅੱਠ ਦੋ ਲੱਖ ਪੰਜ ਹਜ਼ਾਰ ਦਸ ਤਿੰਨ ਲੱਖ ਦੋ ਹਜ਼ਾਰ ਵੀਹ ਪੱਚੀ ਹਜ਼ਾਰ ਦੋ ਹਜ਼ਾਰ ਅੱਠ